ਹਾਂਜੀ ਜਿਹੜਾ ਭੰਗੜੇ ਦੀ ਨਾ ਬਹੁਤ ਜ਼ਿਆਦਾ ਮਹੱਤਵ ਹੈ ਜੀ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਭੰਗੜਾ ਪਾਇਆ ਜਾਂਦਾ ਹੈਗਾ ਭੰਗੜਾ ਹੈਗਾ ਜਿਹੜਾ ਖੁਸ਼ੀ ਦਾ ਉਤਸਾਹ ਦਾ ਹੈ ਨਾ ਉਮੰਗ ਦਾ ਇੱਕ ਪ੍ਰਤੀਕ ਹੈਗਾ ਜਦੋਂ ਬੰਦਾ ਖੁਸ਼ ਹੁੰਦਾ ਨਾ ਤਾਂ ਪੰਜਾਬ ਵੀ ਕਹਿੰਦੇ ਭੰਗੜਾ ਹੀ ਪਾਉਂਦਾ ਹੈਗਾ ਉਹ ਜੇ ਭੰਗੜੇ ਪਾਉਣ ਦੇ ਲਈ ਕੀ ਖਾਸ ਮਕਸਦ ਦੀ ਤਾਂ ਲੋੜ ਨਹੀਂ ਜੇ ਪੰਜਾਬੀਆਂ ਦੇ ਘਰੇ ਮੁੰਡਾ ਹੋਇਆ ਪੰਜਾਬੀ ਤਾਂ ਭੰਗੜਾ ਪਾ ਲੈਂਦੇ ਨੇ ਜੇ ਪੰਜਾਬੀਆਂ ਦੇ ਭਾਈ ਕੋਈ ਫਸਲ ਵਧੀਆ ਹੋ ਗਈ ਹੈ ਨਾ ਪੰਜਾਬੀ ਤਾਂ ਭੰਗੜਾ ਪਾਉਂਦੇ ਨੇ ਠੀਕ ਹੈ ਜੇ ਵਿਆਹ ਸ਼ਾਦੀ ਹੋਣ ਤਾਂ ਪੰਜਾਬੀ ਭੰਗੜਾ ਪਾਉਂਦੇ ਹੀ ਪਾਉਂਦੇ ਹੈਗੇ ਹੈ ਨਾ ਵੀ ਆਪਾਂ ਕੀ ਆ ਨਿੱਕੀ ਨਿੱਕੀ ਗੱਲ 'ਤੇ ਖੁਸ਼ੀ ਮਨਾਉਣ ਨੂੰ ਖੁਸ਼ੀ ਦਾ ਇਜ਼ਹਾਰ ਕਰਨ ਦਾ ਇੱਕ ਤਰੀਕਾ ਹੈਗਾ ਭੰਗੜਾ ਪੰਜਾਬ ਦੇ ਇੱਕ ਮੁੰਡੇ ਕੁੜੀਆਂ ਬਜ਼ੁਰਗ ਕੀ ਸਭ ਹੀ ਭੰਗੜਾ ਪਾਉਂਦੇ ਹੈਗੇ ਤਾਂ ਭੰਗੜੇ ਦੀ ਜਿਹੜੀ ਬ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈਗੀ ਜਨਮ ਤੋਂ ਲੈ ਕੇ ਮਰਨ ਤੱਕ ਭੰਗੜੇ ਨੂੰ ਮਹੱਤਵਪੂਰਣ ਜਿਹੜਾ ਮੰਨਿਆ ਜਾਂਦਾ ਹੈਗਾ ਮਰ ਮਰਨ ਤੀਕਰ ਮੈਂ ਕਿਉਂ ਕਿਹਾ ਨਾ ਕਿਉਂਕਿ ਜਿਹੜੇ ਆਪਣੇ ਬਜ਼ੁਰਗ ਹੈਗੇ ਦੇਖਿਆ ਸਪ ਸਾਡੇ ਪੰਜਾਬ ਦੇ ਵਿੱਚ ਨਾ ਸੌ ਦੇ ਨੀਅਰ ਹੁੰਦੇ ਨੇੜੇ ਹੁੰਦੇ ਖੂ ਕੇ ਮੌਤ ਹੁੰਦੀ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਅਰਥੀ ਨੂੰ ਸਜਾ ਕੇ ਮੂਹਰੇ ਭੰਗੜੇ ਪਾ ਕੇ ਉਹਨਾਂ ਨੂੰ ਐਂ ਵਿਦਾ ਕਰਕੇ ਆਉਂਦੇ ਹੈਗੇ ਠੀਕ ਹੈ ਹੁਣ ਭੰਗੜਾ ਤਾਂ ਹੁਣ ਇੰਨਾ ਜ਼ਿਆਦਾ ਫੇਮਸ ਹੋਇਆ ਪਿਆ ਪੰਜਾਬ ਦੇ ਵਿੱਚ ਗੱਲਾਂ ਹੀ ਛੱਡੋ ਸਕੂਲਾਂ ਕਾਲਜਾਂ ਦੇ ਵਿੱਚ ਪੂਰਾ ਫੈਮਸ ਫੀਮਸ ਹੈ ਇੰਟਰਨੈਸ਼ਨਲ ਲੈਵਲ 'ਤੇ ਵੀ ਇਹਦੇ ਕੰਪੀਟੀਸ਼ਨ ਹੁੰਦੇ ਹੁਣ ਯੂਨੀਵਰਸਿਟੀ ਦੇ ਭੰਗੜਾ ਕੰਪੀਟੀਸ਼ਨ ਹੋਏ ਨੇ ਹੈ ਨਾ ਮੈਂ ਦੇਖਿਆ ਸੀ ਉਹਦੇ ਡੀਡੀ ਪੰਜਾਬੀ 'ਤੇ ਆ ਰਹੇ ਸੀ ਤਾਂ ਬਹੁਤ ਵਧੀਆ ਲੱਗ ਰਿਹਾ ਸੀ ਨਾ ਵੀ ਉਹ ਨਵੇਂ ਨਵੇਂ ਸਟੈਪ ਮੁੰਡੇ ਉਹ ਲੈ ਕੇ ਆਉਂਦੇ ਨੇ ਭੰਗੜੇ ਦੇ ਤਾਂ ਵੀ ਭੰਗੜਾ ਤਾਂ ਬਹੁਤ ਜ਼ਿਆਦਾ ਮਹੱਤਵਪੂਰ ਪੂਰਨ ਹੈਗਾ ਆਪਣੇ ਪੰਜਾਬ ਦੇ ਵਿੱਚ ਇਹ ਜਿਹੜਾ ਪੰਜਾਬ ਜੇ ਆਪਾਂ ਗੱਲ ਕਰੀਏ ਸਿਰਫ ਪੰਜਾਬ ਦੇ ਵਿੱਚ ਹੀ ਪ੍ਰਚਲਿਤ ਨਹੀਂ ਗਾ ਭੰਗੜਾ ਆਪਣਾ ਜਿਵੇਂ ਜਿਵੇਂ ਆਪਣੇ ਪੰਜਾਬੀ ਹੈ ਕੋਈ ਕੈਨੇਡਾ ਦੇ ਵਿੱਚ ਗਿਆ ਕੋਈ ਆਸਟਰੇਲੀਆ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਆਪਣੇ ਪੰਜਾਬੀ ਗਏ ਆ ਜਦੋਂ ਵਿਆਹ ਸ਼ਾਦੀ ਕਰਦੇ ਆ ਤਾਂ ਉੱਥੇ ਵੀ ਭੰਗੜੇ ਖੂਬ ਪੈਂਦੇ ਆ ਮੈਨੂੰ ਪਹਿਲਾਂ ਤਾਂ ਆਪਾਂ ਨੂੰ ਇਹ ਲੱਗਦਾ ਸੀ ਉਹ ਤਾਂ ਭੁੱਲ ਗਏ ਹੋਣਗੇ ਨਹੀਂ ਅਤੇ ਉੱਥੇ ਵੀ ਦੇਖੋ ਇੱਧਰਲੇ ਕਲਾਕਾਰ ਜਾ ਕੇ ਜਾਂਦੇ ਨੇ ਇੱਧਰਲੇ ਕਲਾਕਾਰਾਂ ਨੂੰ ਬੁਲਾਉਂਦੇ ਨੇ ਭੰਗੜਾ ਪਾਉਣ ਅਤੇ ਫਿਰ ਉਹ ਆਪਣੇ ਭੰਗੜਾ ਪਾਉਂਦੇ ਨੇ ਬਰਾਤ ਦੇ ਮੂਹਰੇ ਉਹ ਆਪ ਹੀ ਪੂਰਾ ਭੰਗੜਾ ਸਿੱਖਦੇ ਨੇ ਉਹ ਮੁੰਡੇ ਕੁੜੀਆਂ ਇਹੀ ਉਹ ਸੌਂਗ ਦੇ ਉੱਪਰ ਭੰਗੜਾ ਪਾਉਂਦੇ ਨੇ ਜਿਹੜੇ ਕਪਲ ਹੁੰਦੇ ਵਿਆਹ ਵਾਲੇ ਨਾ ਉਹ ਐਂ ਹੈ ਵੀ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਹੀ ਜਿਹੜਾ ਭੰਗੜਾ ਮਨਾਇਆ ਜਾਂਦਾ ਪਾਇਆ ਜਾਂਦਾ ਹੈਗਾ ਜਿੱਥੇ ਜਿੱਥੇ ਪੰਜਾਬੀ ਵੱਸਦਾ ਹੈਗਾ ਉੱਥੇ ਉੱਥੇ ਜਿਹੜਾ ਭੰਗੜਾ ਪਾਇਆ ਜਾਂਦਾ ਹੈਗਾ ਹੁਣ ਆਪਣਾ ਦਲਜੀਤ ਦੋਸਾਂਝ ਹੈਗਾ ਪੰਜਾਬੀ ਦਾ ਜੇ ਆਪਣਾ ਐਕਟਰ ਹੈਗਾ ਬਹੁਤ ਵਧੀਆ ਮੁੰਡਾ ਉਹ ਉਹਨੇ ਆਪਣੇ ਇੱਕ ਭੰਗੜੇ ਦੀ ਇੰਟਰਨੈਸ਼ਨਲ ਤੀਕਰ ਪਚ ਪਹੁੰਚਾ ਤਾ ਹੈ ਨਾ ਤਾਂ ਜਿਹੜਾ ਭੰਗੜਾ ਨਾ ਇਕੱਲੇ ਪੰਜਾਬ ਤੀਕਰ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਪ੍ਰਸਿੱਧ ਹੈਗਾ ਅਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਪੰਜਾ ਬੀ ਹੋਣ ਦੇ ਨਾਤੇ ਵੀ ਜਿਹੜਾ ਸਾਡਾ ਲੋਕ ਨਾਚ ਹੈਗਾ ਹੁਣ ਸਾਡਾ ਇੰਟਰਨੈਸ਼ਨਲ ਲੈਵਲ 'ਤੇ ਪਛਾਣਿਆ ਜਾਂਦਾ ਹੈਗਾ ਵੀ ਅੰਗਰੇਜ਼ ਵੀ ਇਹਤੇ ਭੰਗੜਾ ਪਾਉਂਦੇ ਹੈਗੇ ਧੰਨਵਾਦ